ਮੇਰੀ ਮਨਪਸੰਦ ਕਿਤਾਬ ਗੋਦਾਨ ਹੈ ਗੋਦਾਨ ਇੱਕ ਹਿੰਦੀ ਨਾਵਲ ਹੈ ਹਿੰਦੀ ਪ੍ਰੇਮ ਚੰਦ ਇੱਕ ਨਾਵਲਕਾਰ ਹੈ ਜਿਹਦਾ ਨਾਵਲ ਹੈ ਇਹਦੇ ਗੋਦਾਨ ਦੀ ਕਹਾਣੀ ਮੈਨੂੰ ਬਹੁਤ ਪਸੰਦ ਹੈ ਗੋਦਾਨ ਇੱਕ ਪੇਂਡੂ ਸਮਾਜ ਨਾਲ਼ ਜੁੜਿਆ ਹੋਇਆ ਨਾਵਲ ਹੈ ਜਿਹਦੇ ਵਿੱਚ ਸਾਰੇ ਹੀ ਪਾਤਰ ਪਿੰਡ ਵਿੱਚੋਂ ਲਏ ਗਏ ਹਨ ਸਾਰੇ ਹੀ ਪਾਤਰ ਨਿਮਨ ਵਰਗ ਵਿੱਚੋਂ ਲਏ ਗਏ ਹਨ ਜਿਹੜੇ ਕਿ ਜਮੀਂਦਾਰੀ ਪ੍ਰਥਾ ਦੇ ਦਬਾਅ ਹੇਠ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਨੇ ਗੋਦਾਨ ਦਾ ਇਹਦੇ ਵਿੱਚ ਜ਼ਿੰਦਗੀ ਦੇ ਪਹਿਲੇ ਸਫ਼ੇ ਤੋਂ ਲੈ ਕੇ ਅੰਤਿਮ ਅਧਿਆਏ ਤੱਕ ਇਹੀ ਗੱਲ ਇੱਕ ਗੋਦਾਨ ਦੀ ਸਮੱਸਿਆ ਗੋਦਾਨ ਸਮਝਦੇ ਹੋ ਗੋਦਾਨ ਦਾ ਮਤਲਬ ਹੈ ਕਿ ਗਊ ਦਾ ਦਾਨ ਜਿਹੜਾ ਕਿ ਹਿੰਦੂ ਧਰਮ ਵਿੱਚ ਇੱਕ ਮਾਨਤਾ ਸੀਗੀ ਕਿ ਜਿਹੜਾ ਬੰਦਾ ਹਰੇਕ ਬੰਦੇ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਗਊ ਦਾ ਦਾਨ ਕਰਨਾ ਜ਼ਰੂਰੀ ਹੈ ਜਿਹੜੀ ਸਾਰੇ ਇਹਦੇ ਦੁਆਲੇ ਹੀ ਘੁੰਮਦੀ ਹੈ ਇਹ ਤੋਂ ਮੈਂ ਇਸ ਨਾਵਲ ਤੋਂ ਮੈਂ ਇਹ ਸਿੱਖਿਆ ਲਈ ਹੈ ਕਿ ਸਾਨੂੰ ਕਦੇ ਵੀ ਆਪਣੀ ਮਾਨਸਿਕਤਾ ਨੂੰ ਕਿਸੇ ਦੇ ਅਧੀਨ ਨਹੀਂ ਕਰਨਾ ਚਾਹੀਦਾ ਸਾਡੀ ਮਾਨਸਿਕਤਾ ਸਾਡੇ 'ਤੇ ਹੀ ਡਿਪੈਂਡ ਕਰਦੀ ਹੋਏ ਸਾਡੀ ਭਲਾਈ ਲਈ ਹੋਏ ਨਾ ਕਿ ਅਸੀਂ ਸਮਾਜ ਵਿੱਚ ਉਹਨਾਂ ਦੱਬੇ ਕੁਚਲੇ ਲੋਕਾਂ ਦਾ ਹਿੱਸਾ ਬਣ ਕੇ ਹੀ ਰਹਿ ਜਾਈਏ ਜਿਹੜੀ ਇਸ ਕਹਾਣੀ ਵਿੱਚ ਸਾਰੇ ਨਾਵਲ ਦੇ ਇੱਕ ਜਮੀਂਦਾਰੀ ਪ੍ਰਥਾ ਵਿੱਚ ਦੇ ਦਬਾਵ ਹੇਠ ਹੀ ਜ਼ਿੰਦਗੀ ਬਿਤਾ ਦਿੰਦੇ ਹਨ ਧੰਨਵਾਦ